ਹੈਲੋ ਹਾਂਜੀ ਵਧੀਆ ਵੀਰੇ ਸਤਿ ਸ਼੍ਰੀ ਅਕਾਲ ਹੈਲੋ ਵਧੀਆ ਵੀਰੇ ਤੁਸੀਂ ਸੁਣਾਓ ਹਾਂਜੀ ਹਾਂਜੀ ਵੀਰੇ ਹੁਣੀ ਹੁਣੀ ਆਹੀ ਸਾਲ ਹੋਇਆ ਨਹੀਂ ਵੀਰੇ ਹਜੇ ਲੱਗਿਆ ਨਹੀਂ ਦੇਖ ਰਿਹਾ ਕੋਈ ਜੋਬ ਮਿਲ ਜੇ ਵਧੀਆ ਹਾਂਜੀ ਹਾਂਜੀ ਵੀਰੇ ਹਾਂਜੀ ਹਾਂਜੀ ਬੀਟੈਕ ਕੀਤੀ ਹੈ ਹਾਂਜੀ ਹਾਂਜੀ ਵੀਰੇ ਉਹ ਤਾਂ ਆਪਣਾ ਉਹ ਇੱਦਾਂ ਨਾ ਕਿ ਆਪਣੀ ਕਿਹੜੀ ਬਰਾਂਚ ਆਪਾਂ ਨੇ ਕੀਤੀ ਆ ਸਟੱਡੀ ਉਸ ਰਿਲੇਟਿਡ ਫਿਰ ਅੱਗੇ ਜੋਬ ਕਰੀ ਕੈ ਆਪਣਾ ਨਿਕਲ ਆਉਂਦਾ ਕਰੀਅਰ ਵਧੀਆ ਚਾਹੇ ਸੋਫਟਵੇਅਰ ਦੇ ਵਿੱਚ ਕੀਤੀ ਹੋਈ ਜਿਵੇਂ ਸੀ ਐੱਸ ਈ ਹੋ ਗਈ ਕੰਪਿਊਟਰ ਸਾਇੰਸ ਅਤੇ ਮਕੈਨੀਕਲ ਇੰਜੀਨੀਅਰਿੰਗ ਇਲੈਕਟ੍ਰੀਕਲ ਓਕਣੇ ਜੋਬਸ ਨੇ ਉਹਨਾਂ ਦੀਆਂ ਮੈਂ ਵੀਰੇ ਮਕੈਨੀਕਲ ਇੰਜੀਨੀਅਰਿੰਗ ਹਾਂਜੀ ਹਾਂਜੀ ਵੀਰੇ ਅੱਗੇ ਮਤਲਬ ਇਹਦੇ ਵਿੱਚ ਵੀ ਬਹੁਤ ਸਕੋਪ ਆ ਜੋਬ ਬੜੀ ਓਪੋਰਚੁਨਿਟੀਜ ਨੇ ਇਹਦੀਆਂ ਵੱਡੇ ਇੰਡਸਟਰੀਜ਼ ਦੇ ਵਿੱਚ ਜਾ ਸਕਦੇ ਹੋ ਤੁਹਾਡਾ ਜਿਵੇਂ ਰਿਸੂਮੇ ਜਾਂਦਾ ਹੈਗਾ ਇੰਟਰਵਿਊ ਵਧੀਆ ਗਈ ਹੋਵੇ ਤੁਹਾਡੀ ਜੋਬ ਮਿਲ ਜਾਂਦੀ ਤੁਹਾਨੂੰ ਵਧੀਆ ਇੰਡਸਟਰੀਜ਼ 'ਚ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਂ ਡਿਜ਼ਾਈਨਿੰਗ ਦੇ ਵਿੱਚ ਹਾਂਜੀ ਹਾਂਜੀ ਹਾਂਜੀ ਵੀਰੇ ਮੈਂ ਦੇਖ ਰਿਹਾ ਕੋਈ ਵਧੀਆ ਜਿਹੀ ਕੰਪਨੀ ਮਿਲੇ ਮੈਂ ਅਪਲਾਈ ਕਰਾਂ ਹਜੇ ਤਾਂ ਮੈਂ ਹਜੇ ਰੀਸਰਚ ਚੈੱਕ ਰਿਹਾ ਸਰਚ ਕਰ ਰਿਹਾ ਕੋਈ ਵਧੀਆ ਜਿਹੀ ਕੰਪਨੀ ਮਿਲ ਜੇ ਮੈਨੂੰ ਜੀ ਵੈਬਸਾਈਟ ਜਿਵੇਂ ਹੁਣ ਲਿੰਕਡਇੰਨ ਦੇ ਵਿੱਚ ਮੈਂ ਪ੍ਰੋਫਾਈਲ ਬਣਾਈ ਸੀਗੀ ਉਹਦੇ 'ਤੇ ਵੀ ਮੈਂ ਕੀਤਾ ਹੋਇਆ ਕਿ ਓਪਨ ਫੋਰ ਸੋਫਟਵੇਅਰ ਡਿਜ਼ਾਇਨਿੰਗ ਜੋਬ 'ਤੇ ਦੇਖ ਰਿਹਾ ਮੈਂ ਫਿਰ ਤੁਸੀਂ ਵੀਰੇ ਕੀ ਕੀਤਾ ਹੋਇਆ ਦੁਬਾਰਾ ਤੋਂ ਦੱਸਿਓ ਅੱਛਾ ਮੈਂ ਹਾਂਜੀ ਵੀਰੇ ਲੱਗ ਸਕਦੀ ਹੈ ਤੁਹਾਡੀ ਜੋਬ ਵੀ

ਹਾਂਜੀ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਹੈ ਹਾਂਜੀ ਹਾਂਜੀ ਉਹਨਾਂ ਦੀ ਹੋ ਜਾਂਦੀ ਹੈ ਪਰ ਉੱਥੇ ਵੀ ਆ ਤੁਹਾਡੇ ਕੋਲ ਇਹੀ ਪੁੱਛਣਗੇ ਕਿ ਤੁਸੀਂ ਪਹਿਲਾਂ ਕਿਤੇ ਇਹ ਕੰਮ ਕੀਤਾ ਕੋਈ ਐਕਸਪੀਰੀਅੰਸ ਹੈਗਾ ਮੈਂ ਜੇ ਤੁਹਾਨੂੰ ਸੁਜੈਸ਼ਨ ਦੇਵਾਂ ਤਾਂ ਤੁਸੀਂ ਪਹਿਲਾਂ ਨਾ ਸਕੂਲ ਟੀਚਰ ਦੇ ਵੱਲੋਂ ਜਾਓ ਕਿਉਂਕਿ ਜਿਵੇਂ ਥੋਡਾ ਐਕਸਪੀਰੀਅੰਸ ਵਧੂਗਾ ਨਾ ਆਪਣੇ ਆਪ ਤੁਹਾਨੂੰ ਜੋਬ ਓਪਰਚੁਨੀਟੀਜ਼ ਆਉਣਗੀਆਂ ਹਾਂਜੀ ਕੋਈ ਕੋਈ ਵੀ ਵੀਰੇ ਕੋਈ ਵੀ ਵਧੀਆ ਸਕੂਲ ਕਰ ਲਓ ਤੁਸੀਂ ਜੇ ਸਕੂਲ ਦੇ ਵਿੱਚ ਤੁਹਾਨੂੰ ਔਖਾ ਲੱਗ ਰਿਹਾ ਕਾਲਜਸ 'ਚ ਅਪਲਾਈ ਕਰ ਲਓ

ਅੱਛਾ ਉੱਥੇ ਵੀ ਐਕਸਪੀਰੀਐਂਸ ਮੰਗਦੇ ਆ ਹਾਂਜੀ ਹਾਂਜੀ ਅੱਛਾ ਹਾਂ ਵੀਰੇ ਤੁਸੀਂ ਇਕੱਲਾ ਟੀਚਿੰਗ ਵੱਲ ਹੀ ਜਾਣਾ ਨਹੀਂ ਨਹੀਂ ਵੀਰੇ ਮੈਂ ਤੁਹਾਡੇ ਤੋਂ ਪੁੱਛ ਰਿਹਾ ਕਿ ਤੁਸੀਂ ਟੀਚਿੰਗ ਲਾਈਨ ਵੱਲ ਹੀ ਜਾਣਾ ਜਾਂ ਕੋਈ ਹੋਰ ਹੋਰ ਜੋਬਸ ਜਿਵੇਂ ਗਵਰਮੈਂਟ ਸਰਵਿਸ 'ਚ ਆ ਜਾਂਦੇ ਨੇ ਓਕਣ ਕੋਈ ਕਰਨਾ ਓਕੇ ਤੁਸੀਂ ਐਂ ਕਰੋ ਨਾ ਕ ਇੱਕ ਪੰਜਾਬ ਦਾ ਸਟੇਟ ਟੀਚਰ ਇਲੀਜੀਬਿਲਟੀ ਟੈਸਟ ਹੁੰਦਾ ਗਾ ਉਹ ਤੁਸੀਂ ਇੱਕ ਵਾਰ ਕਰਕੇ ਦੇਖੋ ਹਾਂਜੀ ਉਹਦੇ ਨਾਲ ਫਿਰ ਤੁਹਾਨੂੰ ਇਹ ਹੋਵੇਗਾ ਨਾ ਕਿ ਤੁਹਾਡਾ ਇੱਕ ਤਾਂ ਉਹ ਹੋਜੂਗਾ ਲੈਬਲ ਵੀ ਹਾਈ ਅਤੇ ਤੁਹਾਨੂੰ ਜੋਬ ਵੀ ਵਧੀਆ ਮਿਲ ਜੂਗੀ ਹਾਂਜੀ ਨਹੀਂ ਨਹੀਂ ਮੈਂ ਤਾਂ ਵੀਰੇ ਟੀਚਿੰਗ ਵੱਲ ਤਾਂ ਗਿਆ ਹੀ ਨਹੀਂ ਮੈਂ ਹਜੇ ਤਾਂ ਮਤਲਬ ਬੀਟੈਕ ਮੇਰੀ ਤਾਂ ਦੂਸਰੀ ਜੋਬ ਗੀ ਸੋਫਟਵੇਅਰ ਦੀ ਡਿਜ਼ਾਇਨਿੰਗ ਵਾਲਾ ਹਾਂਜੀ ਮੈਂ ਲੱਗਿਆ ਗਾ ਹੈਪੀ ਫੋਰਜਿੰਗ ਦੇ ਵਿੱਚ ਅ ਹਾਂਜੀ ਸਾਹਨੇਵਾਲ ਸਾਹਨੇਵਾਲ ਹਾਂਜੀ ਹਾਂਜੀ ਹਾਂਜੀ ਹਾਂਜੀ ਵੀਰੇ ਕੋਈ ਚੱਕਰ ਨਹੀਂ ਓਕੇ ਵੀਰੇ ਓਕੇ ਹਾਂਜੀ ਹਾਂਜੀ ਵੀਰੇ ਹਾਂਜੀ ਕੋਈ ਨਾ ਵੀਰੇ ਮੈਂ ਹੈਗਾ ਓਕੇ